ਯੋਗਾ ਸਾਡੀ ਲਾਈਫ 'ਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਯੋਗੇ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ ਜੋ ਕਿ ਸਾਨੂੰ ਦਵਾਈਆਂ ਨਾਲ ਠੀਕ ਕਰਨੀਆਂ ਪੈਂਦੀਆਂ ਨੇ ਜਿਵੇਂ ਕਿ ਅਸੀਂ ਸਵੇਰੇ ਉੱਠ ਕੇ ਸੈਰ ਕਰੀਏ ਤਾਂ ਉਸ ਨਾਲ ਸਾਡੇ ਸਰੀਰ ਨੂੰ ਬੜਾ ਬੈਨੀਫਿਟ ਮਿਲਦਾ ਹੈ ਅਸੀਂ ਪੂਰਾ ਦਿਨ ਤਰੋ ਤਾਜ਼ਾ ਰਹਿੰਦੇ ਹਨ ਉਸ ਤੋਂ ਇਲਾਵਾ ਅਸੀਂ ਕਸਰਤ ਵਗੈਰਾ ਰਨਿੰਗ ਵਗੈਰਾ ਕਰਦੇ ਹਾਂ ਤਾਂ ਇਹ ਵੀ ਸਾਡੇ ਇਸ ਦਾ ਵੀ ਸਾਡੀ ਲਾਈਫ 'ਚ ਬੜਾ ਵਧੀਆ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਅਸੀਂ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਹੋਵੇਗੀ ਅਸੀਂ ਜ਼ਿਆਦਾ ਸੋਚਦੇ ਹੋਣ ਤਾਂ ਉਸ ਨਾਲ ਸਾਨੂੰ ਮਤਲਵ ਬਰੇਨ 'ਚ ਸਾਡੇ ਟਿਊ ਮਤਲਬ ਦਰਦ ਜਹੀ ਰਹਿੰਦੀ ਹੈ ਤਾਂ ਉਸ ਕੇਸ ਵਿੱਚ ਅਸੀਂ ਅਗਰ ਮੈਡੀਟੇਸ਼ਨ ਕਰਨ ਤਾਂ ਉਸ ਤੋਂ ਅਸੀਂ ਆਰਾਮ ਨਾਲ ਛੁਟਕਾਰਾ ਪਾ ਸਕਦੇ ਹਨ ਹੋਰ ਵੀ ਜਿਵੇਂ ਕਿ ਸਾਨੂੰ ਸਿਰ ਪੀੜ ਹੁੰਦੀ ਹੋਵੇ ਡੇਲੀ ਤਾਂ ਉਸ ਕੇਸ ਵਿੱਚ ਅਸੀਂ ਨਾਰੀਅਲ ਤੇਲ ਨੱਕ 'ਚ ਪਾ ਕੇ ਮੈਡੀਟੇਸ਼ਨ ਵਗੈਰਾ ਕਰੀਏ ਤਾਂ ਉਸ ਨਾਲ ਵੀ ਇਹ ਬਿਮਾਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਹੋਰ ਵੀ ਕਈ ਚੀਜ਼ਾਂ ਨੇ ਜਿਸ ਨਾਲ ਜਿਸ ਨੂੰ ਕਸਰਤ ਨਾਲ ਅਸੀਂ ਠੀਕ ਕਰ ਸਕਦੇ ਹਨ ਅਤੇ ਇਸ ਦਾ ਸਾਡੀ ਲਾਈਫ ਵਿੱਚ ਬਹੁਤ ਵੱਡਾ ਯੋਗਦਾਨ ਹੈ